ਅੱਜ ਕੱਲ ਦੀ ਟੈਕਨੋਲੋਜੀ ਦੇ ਹਿਸਾਬ ਨਾਲ ਖਬਰਾਂ ਨਾਲ ਅਪਡੇਟ ਰਹਿਣਾ ਬਹੁਤ ਸੌਖਾ ਹੋ ਗਿਆ ਹੈ ਜਿਵੇਂ ਕੀ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਅੱਜ ਕੱਲ ਸੋਸ਼ਲ ਮੀਡੀਆ ਇਨਾ ਕੁ ਵੱਧ ਚੁੱਕਾ ਹੈ ਕਿ ਪਲ ਪਲ ਦੀ ਖਬਰ ਤੁਹਾਡੇ ਕੋਲ ਮਿੰਟਾਂ ਸਕਿੰਟਾਂ ਵਿੱਚ ਪਹੁੰਚ ਜਾਂਦੀ ਹੈ ਤੁਹਾਡੇ ਮੋਬਾਈਲ ਫੋਨ ਦੇ ਰਾਹੀਂ ਜਿਵੇਂ ਕਿ ਕਿਧਰੇ ਕੋਈ ਘਟਨਾ ਵਾਪਰਦੀ ਹੈ ਉਹ ਤੁਹਾਡੇ ਕੋਲ ਘਟਨਾ ਹੋਣ ਦੇ ਕੁਝ ਸਮੇਂ ਬਾਅਦ ਹੀ ਤੁਹਾਡੇ ਕੋਲ ਆ ਜਾਂਦੀ ਹੈ ਅਖਬਾਰ ਵਿੱਚ ਵੀ ਐਹ ਖਬਰ ਆਉਂਦੀ ਹੈ ਪਰ ਘਟਨਾ ਦੇ ਅਗਲੇ ਦਿਨ ਮੈਂ ਜਿਹੜੀ ਨਵੀਂ ਖਬਰ ਪੜੀ ਹੈ ਉਹ ਹੈ ਅਮਰੀਕਾ ਦੇ ਰਾਸ਼ਟਰੀਪਤੀ ਦੇ ਚੋਣਾਂ ਦੀ ਅਮਰੀਕਾ ਵਿੱਚ ਇਸ ਨੂੰ ਲੈ ਕੇ ਬਹੁਤ ਉਤਸ਼ਾਹ ਦੇਖਿਆ ਗਿਆ ਹੈ ਇਸ ਚੋਣਾਂ ਵਿੱਚ ਟਰੰਪ ਨੇ ਬਾਜੀ ਮਾਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਇੱਕ ਹੋਰ ਖਬਰ ਜਿਹੜੀ ਮੈਂ ਨਵੀਂ ਪੜੀ ਹੈ ਉਹ ਹੈ ਸ਼ੇਅਰ ਬਾਜ਼ਾਰ ਦੀ ਜਿਸ ਵਿੱਚ ਅੱਜ ਕੱਲ ਬਹੁਤ ਹੀ ਗਿਰਾਵਟ ਆਈ ਹੋਈ ਹੈ ਜਿਸ ਨਾਲ ਬਹੁਤ ਘਾਟਾ ਹੋ ਰਿਹਾ ਹੈ ਖਬਰ ਦੇ ਹਿਸਾਬ ਨਾਲ ਨਿਵੇਸ਼ਕਾਂ ਦੇ ਕਾਫੀ ਪੈਸੇ ਡੁੱਬ ਗਏ ਨੇ ਜੋ ਕਿ ਬਹੁਤ ਮਾੜਾ ਹੋਇਆ ਪਰ ਖਬਰਾਂ ਇਹ ਵੀ ਕਹਿੰਦੀਆਂ ਨੇ ਕਿ ਆਉਣ ਵਾਲੇ ਸਮੇਂ ਵਿੱਚ ਇਸ ਵਿੱਚ ਦੁਬਾਰਾ ਤੋਂ ਵਾਧਾ ਹੋ ਸਕਦਾ ਹੈ